ਸੇਤੀਆ ਰੈਸਟੋਰੈਂਟ ਤੋਂ ਉਹ ਗੱਲ ਕਰ ਰਹੇ ਹੋ ਮੈਂ ਤੁਹਾਡੇ ਰੈਸਟੋਰੈਂਟ ਦਾ ਬਹੁਤ ਨਾਮ ਸੁਣਿਆ ਵੀ ਤੁਹਾਡੇ ਰੈਸਟੋਰੈਂਟ ਦੀ ਕੁਆਲਿਟੀ ਬਹੁਤ ਵਧੀਆ ਤਾਂ ਜੋ ਤੁਹਾਡੇ ਰੈਸਟੋਰੈਂਟ ਦਾ ਨਾਮ ਪੂਰੇ ਸ਼ਹਿਰ ਵਿੱਚ ਫੇਮਸ ਹੈ ਵੀ ਤੁਸੀਂ ਹਰ ਸਮੇਂ ਤਾਜ਼ਾ ਖਾਣਾ ਬਣਾ ਕੇ ਦਿੰਦੇ ਹੋ ਅਤੇ ਤੁਹਾਡੀ ਪੈਕਿੰਗ ਵੀ ਬਹੁਤ ਵਧੀਆ ਸੁਣੀ ਗਈ ਹੈ ਵੀ ਤੁਹਾਡੀ ਖਾਣੇ ਦੀ ਪੈਕਿੰਗ ਤੁਸੀਂ ਇਸ ਤਰ੍ਹਾਂ ਕਰਦੇ ਹੋ ਵੀ ਕੋਈ ਵੀ ਵਿਅਕਤੀ ਮੰਨ ਲਓ ਜੇ ਕੋਈ ਸਮਾਂ ਪਾ ਕੇ ਖਾਣਾ ਖਾਣਾ ਚਾਹੁੰਦਾ ਤਾਂ ਵੀ ਤੁਹਾਡਾ ਖਾਣਾ ਲੰਬੇ ਸਮੇਂ ਤੱਕ ਵੀ ਤਾਜ਼ਾ ਰਹਿੰਦਾ ਹੈ ਅਤੇ ਮੈਂ ਤੁਹਾਨੂੰ ਸੌ ਸੌਲਾਂ ਕੁ ਜਣਿਆਂ ਦਾ ਔਡਰ ਪੈਕ ਕਰਨਾ ਹੈ ਵੀ ਜਿਸ ਵਿੱਚ ਤੁਹਾਡੇ ਖਾਣੇ ਦੀ ਪੈਕਿੰਗ ਵੀ ਇਸ ਤਰ੍ਹਾਂ ਕਰ ਦਿਓ ਵੀ ਉਹ ਖਾਣਾ ਸਾਨੂੰ ਲੰਮੇ ਸਮੇਂ ਬਾਅਦ ਖਾਣਾ ਪਏ ਤਾਂ ਵੀ ਉਹ ਖਾਣਾ ਤਾਜ਼ਾ ਰਹੇ